ਹੈਲੋ ਨਮਸਤੇ ਸਰ ਸਰ ਤੁਸੀਂ ਡੀਏਵੀ ਕਾਲਜ ਦੇ ਕੰਟੀਨ ਓਨਰ ਬੋਲਦੇ ਹੋ ਸਰ ਤੁਹਾਡੇ ਕੋਈ ਗੱਲਾਂ ਨੋਟ ਕਰਾਉਣੀਆਂ ਸੀਗੀਆਂ ਸਰ ਜਿਹੜੇ ਤੁਹਾਡੇ ਕੰਟੀਨ ਦੇ ਚਾਰਟ ਵਿੱਚ ਮਿਲਦਾ ਨਾ ਚੀਜ਼ਾਂ ਉਹ ਘੱਟ ਨੇ ਥੋੜੀਆਂ ਹਾਂਜੀ ਸਰ ਇੱਥੇ ਕਾਲਜ ਦੇ ਬੱਚੇ ਕਾਫੀ ਜਿਆਦਾ ਆ ਤੇ ਤੁਹਾਡੇ ਆਈਟਮਸ ਘੱਟ ਹੈਗੀਆਂ ਤੁਸੀਂ ਕੁਝ ਹੋਰ ਐਡ ਆਨ ਕਰ ਸਕਦੇ ਹੋ ਓਕੇ ਇਹ ਥੋੜੇ ਘੱਟ ਰਹਿ ਜਾਂਦੇ ਆ ਜਿਵੇਂ ਬੱਚਿਆਂ ਨੇ ਸਵੇਰ ਟਾਈਮਿੰਗ ਜਿਆਦਾ ਹੁੰਦੀ ਹੈ ਕਾਲਜ ਦੀ ਤੇ ਦੂਰੋਂ ਦੂਰੋਂ ਬੱਚੇ ਆਉਂਦੇ ਆ ਤੇ ਉਹਨਾਂ ਨੂੰ ਭੁੱਖ ਵਗੈਰਾ ਲੱਗ ਜਾਂਦੀ ਰਿਫਰੈਸ਼ਮੈਂਟ ਵਗੈਰਾ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਤੇ ਤੁਸੀਂ ਹੋਰ ਕੋਈ ਐਡ ਕਰ ਸਕਦੇ ਹੋ ਇਹਦੇ ਚ ਹਾਂਜੀ ਕਰ ਦੋ ਤਾਂ ਬਹੁਤ ਵਧੀਆ ਗੱਲ ਆ ਠੀਕ ਸਰ ਜੀ ਤੁਸੀਂ ਕਰ ਸਕਦੇ ਹੋ ਤੇ ਐਡ ਔਨ ਕਰ ਦੋ ਵਿੱਚ ਜਿਵੇਂ ਕੁਰਕੁਰਿਆ ਵਗੈਰਾ ਦੀ ਪੈਕਟ ਹੋਰ ਐਡ ਕਰੋ ਹਾਂਜੀ ਤੇ ਕੁਝ ਬੱਚਿਆਂ ਦਾ ਜਿਵੇਂ ਬਰਥਡੇ ਵਗੈਰਾ ਹੁੰਦਾ ਉਹਦੀ ਵੀ ਉਹਨਾਂ ਨੇ ਕਈ ਵਾਰ ਪਾਰਟੀ ਵਗੈਰਾ ਕਰਨੀ ਹੁੰਦੀ ਹੈ ਤੇ ਉਹਦੇ ਵਾਸਤੇ ਵੀ ਥੋੜਾ ਅਰੇਜਮੈਂਟ ਕਰੋ ਹਾਂਜੀ ਤੇ ਚਾਏ ਕਾਫੀ ਕਾਫੀ ਦਾ ਵੀ ਥੋੜਾ ਕਰੋ ਚਾਹੇ ਤਾਂ ਚੱਲ ਤੁਹਾਡੇ ਮਿਲ ਹੀ ਜਾਂਦੀ ਇਥੋਂ ਤੇ ਕਾਫੀ ਦੇ ਵੀ ਕੋਈ ਹੁੰਦੇ ਆ ਪਸੰਦ ਕਰਨ ਵਾਲੇ ਹਾਂਜੀ ਹਾਂਜੀ ਕਾਫੀ ਜਰੂਰ ਕਰ ਦਿਓ ਤੇ ਕੁਝ ਕੁ ਪੈਕਟ ਵਿੱਚ ਐਡ ਕਰੋ ਤੇ ਕੁਝ ਟਿੱਕੀ ਸਮੋਸਾ ਤੁਹਾਡੇ ਹੁੰਦਾ ਹੀ ਆ ਹਾਂਜੀ ਟਿੱਕੀ ਸਮੌਸਾ ਕਰ ਸਕਦੇ ਹੋ ਤੇ ਕਰ ਦੋ ਪੈਟੀਜ਼ ਹੋ ਗਈਆਂ ਹਾਂਜੀ ਐਵੇਂ ਦਾ ਕੁਝ ਐਡ ਕਰੋ ਤੇ ਬੱਚਿਆਂ ਵਾਸਤੇ ਥੋੜਾ ਉਹਨਾਂ ਨੂੰ ਹੈਲਪਫੁਲ ਹੋ ਜਾਏਗਾ ਹਾਂਜੀ ਓਕੇ ਜੀ ਸਰ ਉਹ ਵੀ ਸੀਗਾ ਕੀ ਟੇਬਲ ਵਗੈਰਾ ਦਾ ਵੀ ਥੋੜਾ ਕਰ ਦਿਓ ਥੋੜੇ ਟੇਬਲ ਆ ਤੁਹਾਡੇ ਉਥੇ

ਹਾਂਜੀ ਹਾਂਜੀ ਕਿਉਂਕਿ ਇੱਕੋ ਟਾਈਮ ਤੇ ਛੁੱਟੀ ਰਿਸੈਸ ਹੁੰਦੀ ਆ ਤੇ ਉਸ ਟਾਈਮ ਨਾਲ ਭੀੜਾ ਕਾਫੀ ਹੋ ਜਾਂਦਾ ਤੇ ਉਹਦੇ 'ਚ ਪ੍ਰੋਬਲਮ ਆਉਂਦੀ ਹ ਇਸ ਕਰਕੇ ਤੁਸੀਂ ਟੇਬਲ ਵਗੈਰਾ ਦੇ ਵੀ ਕਰ ਲਓ ਹਾਂਜੀ ਹਾਂਜੀ ਚਲੋ ਠੀਕ ਆ ਥੈਂਕ ਯੂ ਸਰ